ਹੈਲੋ ਸਤਿ ਸ਼੍ਰੀ ਅਕਾਲ ਜੀ ਠੀਕ ਹੈ ਜੀ ਤੁਸੀਂ ਦੱਸੋ ਜੀ ਕਿਵੇਂ ਹੋ ਹੋਰ ਜੀ ਕਿੱਥੋਂ ਬੋਲਦੇ ਸੀ ਪੰਜਾਬ ਤੋਂ ਬੋਲਦੇ ਸੀ ਠੀਕ ਹੈ ਜੀ ਠੀਕ ਹੈ ਜੀ ਅੱਛਾ ਜੀ ਅੱਛਾ ਜੀ ਠੀਕ ਹੈ ਜੀ ਠੀਕ ਹੈ ਜੀ ਨਹੀਂ ਜੀ ਹਲੇ ਤਾਂ ਅਸੀਂ ਫਰੀ ਹੈ ਨਹੀਂ ਜੀ ਹਾਂਜੀ ਕੋਈ ਨਾ ਜੀ ਅਗਲੇ ਮੰਥ ਦੱਸ ਦਾਂਗੇ ਅਤੇ ਕਿੱਥੇ ਕਰਾਉਣਾ ਤੁਸੀਂ ਸ਼ੋਅ ਜੀ ਇਹ ਕਿਹੜੀ ਜਗ੍ਹਾ 'ਤੇ ਕਰਾਉਣਾ ਅੱਛਾ ਠੀਕ ਹੈ ਜੀ ਮਤਲਬ ਮਾਹੌਲ ਵਧੀਆ ਹੋਣਾ ਚਾਹੀਦਾ ਜਿੱਥੇ ਤੁਸੀਂ ਸ਼ੋਅ ਕਰਾਉਣਾ ਰਹਿਣ ਸਹਿਣ ਦਾ ਖਰਚਾ ਅੱਛਾ ਜੀ ਠੀਕ ਹੈ ਅਤੇ ਮਤਲਬ ਸਕੋਰਟੀ ਵਗੈਰਾ ਹੋਣੀ ਚਾਹੀਦੀ ਆ ਕੋਈ ਦਿੱਕਤ ਨਾ ਆਵੇ ਸਿੰਗਿੰਗ ਮਤਲਬ ਅੱਛਾ ਜੀ ਚਲੋ ਠੀਕ ਹੈ ਜੀ ਹੋਰ ਬੁਕਿੰਗ 'ਤੇ ਤਾਂ ਪੰਜਾਹ ਹਜ਼ਾਰ ਲੱਗ ਜਾਣਾ ਜੀ ਵੱਧ ਤੋਂ ਵੱਧ ਹੋਰ ਵੀ ਲੱਗ ਜਾਣਾ ਨਹੀਂ ਸ਼ੋਅ ਇਸ ਟਾਈਮ ਬਹੁਤ ਬੁਕਿੰਗ ਹੋ ਰਹੇ ਨੇ ਜੀ ਤਾਂ ਕਰਕੇ ਬਹੁਤ ਘੱਟ ਪੈਸੇ ਇਹ ਤਾਂ ਤੁਹਾਨੂੰ ਮੈਂ ਬਹੁਤ ਘੱਟ ਦੱਸਿਆ ਮੇਰੇ ਸ਼ੋਅ ਜ਼ਿਆਦਾ ਮਤਲਬ ਹੁੰਦੇ ਆ ਜੀ ਹਾਂਜੀ ਅਗਲੇ ਮੰਥ ਸਹੀ ਹੈ ਜੀ ਅਗਲੇ ਮੰਥ ਰੱਖ ਲਾਂਗੇ ਅਗਲੇ ਮੰਥ ਮੇਰਾ ਕੋਈ ਸ਼ੋਅ ਹੈ ਨਹੀਂ ਹਾਂਜੀ ਓਕੇ ਜੀ ਠੀਕ ਹੈ ਜੀ